ਹਾਂਜੀ ਅਸੀਂ ਆਪਣੀਆਂ ਫੋਟੋਆਂ ਨੂੰ ਸੰਪਾਦਿਤ ਕਰਦੇ ਹਾਂ ਜਦੋਂ ਸਾਡੀ ਕਿੱਟੀ ਹੁੰਦੀ ਹੈ ਜਦੋਂ ਜਾਂ ਫਿਰ ਅਸੀਂ ਕਿਸੇ ਵਿਆਹਵਾਂ 'ਤੇ ਜਾਂਦੇ ਹਾਂ ਤਾਂ ਫਿਰ ਸਾਰੇ ਇਕੱਠੇ ਹੋਏ ਨੇ ਤਿਆਰ ਵੀ ਹੋਏ ਹੁੰਦੇ ਹਾਂ ਤਾਂ ਫੇਰ ਅਸੀਂ ਜਿਵੇਂ ਬਿਊਟੀ ਪਲਸ ਹੋ ਗਈ ਉਹਦੇ ਵਿੱਚ ਫੋਟੋ ਖਿੱਚ ਲੈਂਦੇ ਹਾਂ ਜਾਂ ਫਿਰ ਕੋਈ ਫੋਟੋਗ੍ਰੈਟ ਆ ਉਹਦੇ ਬਾਅਦ 'ਚੋਂ ਅਸੀਂ ਉਹਦੇ ਵਿੱਚ ਕੋਲਾਜ ਬਣਾ ਕੇ ਅਤੇ ਸਨੈਪਚੈਟ ਹੈਗੇ ਬਥੇਰੇ ਸਾਰੇ ਹੋਰ ਵੀ ਨੇ ਅਤੇ ਉਹਨਾਂ ਨੂੰ ਅਸੀਂ ਤਸਵੀਰਾਂ ਲਈ ਵਰਤਦੇ ਹਾਂ